ਦੇਖਿਆ ਜਾਵੇ ਤਾਂ ਕਲਾ ਅਤੇ ਸ਼ਿਲਪਕਾਰੀ ਦੇ ਖੇਤਰ ਵਿੱਚ ਸਾਡਾ ਖੇਤਰ ਬਹੁਤ ਹੀ ਜ਼ਿਆਦਾ ਯੋਗਦਾਨ ਦੇ ਰਿਹਾ ਹੈ ਇੱਥੇ ਬਹੁਤ ਹੀ ਸਸਤੇ ਰੇਟਾਂ 'ਤੇ ਅਤੇ ਬਹੁਤ ਹੀ ਭਰਪੂਰ ਮਾਤਰਾ 'ਚ ਰੋ ਮਟੀਰੀਅਲ ਮਿਲ ਜਾਂਦਾ ਹੈ ਜਿਸ ਨਾਲ ਕਿ ਵਧੀਆ ਢੰਗ ਦੀ ਸ਼ਿਲਪਕਾਰੀ ਹੋ ਸਕਦੀ ਹੈ ਅਤੇ ਸਰਕਾਰ ਵੀ ਇਸ ਵਿੱਚ ਸਾਡਾ ਬਹੁਤ ਜ਼ਿਆਦਾ ਯੋਗਦਾਨ ਦੇ ਰਹੀ ਹੈ ਸਰਕਾਰ ਵੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਨ ਜਾਂ ਤਾਂ ਕਿਫਾਇਤੀ ਪ੍ਰੋਗਰਾਮ ਪ੍ਰੋਵਾਈਡ ਕਰਵਾ ਰਹੀ ਹੈ ਜਿਸ ਵਿੱਚੋਂ ਕਿ ਅਸੀਂ ਸ਼ਿਲਪਕਾਰੀ ਲਈ ਬਹੁਤ ਕੁਝ ਸਿੱਖਦੇ ਹਾਂ ਅਤੇ ਸਾਨੂੰ ਬਹੁਤ ਜ਼ਿਆਦਾ ਸ਼ਿਲਪਕਾਰੀ ਬਾਰੇ ਪਤਾ 'ਚ ਲੱਗਦਾ ਹੈ ਜਿਸ ਨਾਲ ਕੀ ਅਸੀਂ ਆਪਦਾ ਇੱਕ ਵਧੀਆ ਢੰਗ ਦਾ ਬਿਜ਼ਨਸ ਬਣਾ ਸਕਦੇ ਹਾਂ ਅਤੇ ਮੈਂ ਲਾਸਟ ਟਾਈਮ ਹੀ ਇੱਕ ਕਿਫਾਈਤੀ ਪ੍ਰੋਗਰਾਮ ਅਟੈਂਡ ਕੀਤਾ ਸੀਗਾ ਜਿਸ ਵਿੱਚ ਕਿ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਢੰਗ ਦਾ ਸਿੱਖਣ ਨੂੰ ਮਿਲਿਆ ਸੀਗਾ ਅਤੇ ਉਸ ਨਾਲ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਮੈਨੂੰ ਰੋ ਮਟੀਰੀਅਲ ਵਾਰੇ ਵੀ ਬਹੁਤ ਕੁਝ ਪਤਾ ਲੱਗਿਆ ਸੀਗਾ ਜਿਸ ਵਿ ਜੋ ਕਿ ਮੇਰੇ ਲਈ ਬਹੁਤ ਹੀ ਫਾਇਦੇਮੰਦ ਸੀਗਾ ਔਰ ਮੈਂ ਉਹ ਰੋ ਮਟੀਰੀਅਲ ਵੀ ਖਰੀਦਿਆ ਸੀਗਾ ਅਤੇ ਉਸ ਨਾਲ ਮੈਂ ਆਪਣੀ ਬਹੁਤ ਵਧੀਆ ਇੱਕ ਸ਼ਿਲਪਕਾਰੀ ਤਿਆਰ ਕੀਤੀ ਸੀਗੀ